ਉਂਝ ਤਾਂ ਪੂਰੇ ਪੰਜਾਬ ਵਿੱਚ ਕਈ ਕਵੀ ਅਤੇ ਕਈ ਲੇਖਕ ਨੇ ਅਤੇ ਉਹਨਾਂ ਦੀਆਂ ਕਈ ਕਵਿਤਾਵਾਂ ਦਿਲ ਨੂੰ ਇਸ ਤਰ੍ਹਾਂ ਛੂਹ ਜਾਂਦੀਆਂ ਨੇ ਜੋ ਕਦੇ ਵੀ ਦਿਲ ਤੋਂ ਹਟਾਈ ਨਹੀਂ ਜਾਂਦੀਆਂ ਮੇਰੇ ਮਨਪਸੰਦ ਕਵੀ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਜਿਨ੍ਹਾਂ ਦੀ ਕਈ ਸਾਰੀ ਕਵਿਤਾਵਾਂ ਮੈਂ ਪੜ੍ਹੀਆਂ ਅਤੇ ਉਹਨਾਂ ਕਵਿਤਾਵਾਂ ਦਾ ਅਰਥ ਸਮਝਿਆ ਉਹਨਾਂ ਦੀਆਂ ਕਈ ਕਵਿਤਾਵਾਂ ਮੇਰੇ ਦਿਲ ਨੂੰ ਐਸੀ ਲੱਗੀਆਂ ਕਿ ਉਹਨਾਂ ਨੂੰ ਮੇਰਾ ਉਹਨਾਂ ਨੂੰ ਮੈਂ ਪਸੰਦ ਕਰ ਸਕਿਆ ਉਹਨਾਂ ਦੀਆਂ ਕਈ ਕਵਿਤਾਵਾਂ ਪਿਆਰ ਭਰੀਆਂ ਸੱਚੀਆਂ ਅਤੇ ਇੱਦਾਂ ਦੇ ਸਿਰਲੇਖ ਵਾਲੀਆਂ ਹੁੰਦੀਆਂ ਸੀ ਉਨ੍ਹਾਂ ਦੀਆਂ ਕਈ ਕਵਿਤਾਵਾਂ ਜਿਵੇਂ ਕਿ ਆਰਤੀ ਇਸ਼ਤਿਹਾਰ ਅਤੇ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਐਸੀਆਂ ਕਵਿਤਾਵਾਂ ਐਸੇ ਲੇਖ ਪੜ੍ਹ ਕੇ ਮੇਰਾ ਕੀ ਸਭ ਦਾ ਦਿਲ ਮੋਹ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਦੇ ਵੀ ਆਪਣੀ ਯਾਦ 'ਚੋਂ ਨਹੀਂ ਭੁਲਾਇਆ ਜਾਂਦਾ ਹਾਲਾਂਕਿ ਉਹ ਕਵੀ ਅੱਜ ਸਾਡੇ ਵਿੱਚ ਨਹੀਂ ਸਨ ਪਰ ਫਿਰ ਵੀ ਉਹਨਾਂ ਦੀ ਯਾਦ ਇੱਕ ਇਸ ਤਰ੍ਹਾਂ ਸਾਡੇ ਦਿਲ ਵਿੱਚ ਬਹਿ ਚੁੱਕੀ ਹੈ ਕਿ ਉਹਨਾਂ ਨੂੰ ਕਦੇ ਵੀ ਸਾਡੇ ਦਿਲ 'ਚੋਂ ਕੱਢਿਆ ਜਾਂ ਭੁਲਾਇਆ ਨਹੀਂ ਜਾ ਸਕਦਾ ਅਤੇ ਉਹਨਾਂ ਦੀ ਇਹ ਕਵਿਤਾਵਾਂ ਸਾਰੇ ਪੰਜਾਬ ਵਿੱਚ ਸੁਣੀਆਂ ਜਾਂਦੀਆਂ ਨੇ ਅਤੇ ਉਹਨਾਂ ਦੀ ਇਹ ਮਸ਼ਹੂਰ ਕਵਿਤਾ ਕਵਿਤਾ ਜਿਸ ਦੇ ਸਿਰਲੇਖ ਹੈ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਅੱਜ ਵੀ ਬੜੇ ਚਾਵਾਂ ਨਾਲ਼ ਸੁਣਿਆ ਜਾਂਦਾ ਹੈ ਅਤੇ ਮੇਰੇ ਮਨਪਸੰਦ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਇਹ ਕਵਿਤਾ ਹਰ ਪੰਜਾਬੀ ਆਪਣੀ ਜ਼ੁਬਾਨ 'ਤੇ ਜ਼ਰੂਰ ਚੜ੍ਹਾਉਂਦਾ ਹੈ